ਕੀ ਤੁਸੀਂ ਸੋਚਦੇ ਹੋ ਕਿ ਟੀਵੀ ਅਤੇ ਨੌ ਆਨਲਾਈਨ ਅਤੇ ਵਧੇਰੇ ਮੁਫਤ ਵਿਦਿਅਥਿਕ ਸਮਗਰੀ ਉਪਲਬਧ ਕਰਵਾਈ ਜਾਂਦੀ ਹੈ ਅੱਜ ਕੱਲ੍ਹ ਟੀਵੀ ਕੋਈ ਨਹੀਂ ਦੇਖਦਾ ਸਾਰੇ ਫੋਨ ਹੀ ਦੇਖਦੇ ਹਨ ਜੋ ਜਿਹੜਾ ਕੁਛ ਟੀਵੀ 'ਚ ਆਉਂਦਾ ਹੈ ਉਹ ਅਸੀਂ ਫੋਨ 'ਤੇ ਹੀ ਮੰਗਵਾ ਸਕਦੇ ਹਾਂ ਸੀਰੀਅਲ ਵਗੈਰਾ ਫਿਲਮ ਵਗੈਰਾ ਇਸ ਕਰਕੇ ਟੀਵੀ ਤੋਂ ਜ਼ਿਆਦਾ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਫੋਨ ਫੋਨ ਹੀ ਸਭ ਦੁਨੀਆਂ ਹੀ ਸਭ ਤੋਂ ਜ਼ਿਆਦਾ ਵਰਤਦੀ ਹੈ ਮੈਂ ਵੀ ਫੋਨ ਹੀ ਸਭ ਤੋਂ ਜ਼ਿਆਦਾ ਵਰਤਦੀ ਹਾਂ ਅੱਜ ਕੱਲ੍ਹ ਅੱਜ ਦੀ ਪੀੜ੍ਹੀ ਟੀਵੀ ਕੋਈ ਨਹੀਂ ਦੇਖਦੀ ਸਭ ਫੋਨ ਹੀ ਵਰਤਦੇ ਹਨ ਪਹਿਲੇ ਜ਼ਮਾਨੇ 'ਚ ਟੀਵੀ ਦੇਖੇ ਜਾਂਦੇ ਸੀ ਅੱਜ ਦੇ ਜ਼ਮਾਨੇ ਵਿੱਚ ਤਾਂ ਫੋਨ ਹੀ ਸਾਰੇ ਵਰਤਦੇ ਹਨ